ਨਮਸਕਾਰ ਜੀ ਛੇਤੀਆ ਹੋਟਲ ਬਠਿੰਡਾ ਤੋਂ ਗੱਲ ਕਰ ਰਹੇ ਹੋ ਹਾਂਜੀ ਮੈਂ ਬਠਿੰਡਾ ਤੋਂ ਬੋਲ ਰਿਹਾ ਜੀ ਤੁਹਾਨੂੰ ਮੈਂ ਪਹਿਲਾਂ ਗਲਤੀ ਨਾਲ ਆਪਣਾ ਜੋ ਜਿਹੜਾ ਪਤਾ ਦਿੱਤਾ ਸੀ ਉਹ ਥੋੜ੍ਹਾ ਜਿਹਾ ਫ਼ਰਕ ਰਹਿ ਗਿਆ ਸੀ ਸਾਡਾ ਜਿਹੜਾ ਮੇਰਾ ਪਤਾ ਹੈਗਾ ਡਿਲੀਵਰੀ ਦਾ ਉਹ ਜਿਹੜਾ ਮਤਲਬ ਗੋਲ ਡਿੱਗੀ ਦੇ ਨੇੜੇ ਨਈ ਬਸਤੀ ਹੈ ਜੀ ਗਲੀ ਨੰਬਰ ਪੰਜ ਦੇ ਵਿੱਚ ਸੀਗਾ ਅਤੇ ਮੈਂ ਤੁਹਾਨੂੰ ਗਲਤੀ ਨਾਲ ਚਾਰ ਲਿਖਵਾ ਦਿੱਤਾ ਅਤੇ ਕਿਰਪਾ ਕਰਕੇ ਜਿਹੜਾ ਮੇਰਾ ਇਹ ਆਰਡਰ ਹੈ ਡਿਲੀਵਰੀ ਹੈ ਮੇਰੇ ਔਡਰ ਦੀ ਇਹ ਗਲੀ ਨੰਬਰ ਪੰਜ ਦੇ ਵਿੱਚ ਕੀਤੀ ਜਾਵੇ ਤਾਂ ਤਾਂ ਕਿ ਮੈਨੂੰ ਠੀਕ ਸਮੇਂ 'ਤੇ ਮਿਲ ਸਕੇ ਮੈਂ ਤੁਹਾਨੂੰ ਡਿਨਰ ਦਾ ਔਡਰ ਦਿੱਤਾ ਸੀ ਪੰਜ ਲੋਕਾਂ ਦਾ ਤਾਂ ਤੁਸੀਂ ਪੰਜ ਡਿਨਰ ਦੇ ਜਿਹੜੇ ਔਡਰ ਹੈ ਉਹ ਮੇਰੇ ਇਸ ਪਤੇ 'ਤੇ ਪਜਾਓ ਅਤੇ ਤੁਹਾਡਾ ਜਿਹੜਾ ਮਤਲਬ ਹੋਟਲ ਦਾ ਬਹੁਤ ਵੱਡੀ ਰੈਪੋ ਹੈਗੀ ਹੈ ਅਤੇ ਪਹਿਲਾਂ ਵੀ ਮੈਂ ਤੁਹਾਡੇ ਤੋਂ ਆਰਡਰ ਲੈਂਦਾ ਰਹਿੰਦਾ ਤਾਂ ਤੁਹਾਡਾ ਕਾਫ਼ੀ ਅੱਛਾ ਖਾਣਾ ਹੁੰਦਾ ਅਤੇ ਤੁਹਾਡਾ ਖਾਣਾ ਮੈਨੂੰ ਪਸੰਦ ਹੈ ਇਸ ਕਰਕੇ ਮੈਂ ਮਤਲਬ ਤੁਹਾਨੂੰ ਲਿਖਵਾਇਆ ਲੇਕਿਨ ਗਲਤੀ ਨਾਲ ਗਲੀ ਨੰਬਰ ਚਾਰ ਲਿਖਿਆ ਗਿਆ ਤਾਂ ਮੇਰਾ ਇਹ ਆਰਡਰ ਤੁਸੀਂ ਗਲੀ ਨੰਬਰ ਪੰਜ ਦੇ ਵਿੱਚ ਪਹੁੰਚਾਉਣ ਦੀ ਕਿਰਪਾਲਤਾ ਕਰੋ ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਜਿਹੜਾ ਮੇਰਾ ਇਹ ਔਡਰ ਪੋਚ ਪਹੁੰਚਾਉਣ 'ਚ ਮੇਰੀ ਮਦਦ ਕਰੋਗੇ ਅਤੇ ਮੇਰੀ ਗਲਤੀ ਹੈ ਜਿਹੜੀ ਉਹਨੂੰ ਨਾਲ਼ ਧਿਆਨ 'ਚ ਰੱਖਦੇ ਹੋਏ ਮੇਰੇ ਨਵੇਂ ਪਤੇ 'ਤੇ ਆਰਡਰ ਪਹੁੰਚਾਓਗੇ ਤਾਂ ਕਿ ਮੈਂ ਤੇ ਮੇਰਾ ਜਿਹੜਾ ਪਰਿਵਾਰ ਮੇਰਾ ਦੋਸਤ ਆ ਜਿਹੜੇ ਅਸੀਂ ਉਸ ਖਾਣੇ ਦਾ ਜਿਹੜਾ ਤੁਹਾਡੇ ਖਾਣੇ ਦਾ ਤੁਹਾਡਾ ਜਿਹੜਾ ਬਹੁਤ ਵਧੀਆ ਖਾਣਾ ਜਿਹਦੀ ਬਹੁਤ ਵਧੀਆ ਮਤਲਬ ਮਾਰਕੀਟ ਦੇ ਵਿੱਚ ਨਾਮ ਹੈਗਾ ਤਾਂ ਤੁਸੀਂ ਮੇਰਾ ਮੈਨੂੰ ਉਹ ਖਾਣਾ ਪਹੁੰਚਾ ਕੇ ਅਤੇ ਜਿਹੜੀ ਮਤਲਬ ਮੇਰੀ ਜਿਹੜੀ ਹੈ ਮਦਦ ਜ਼ਰੂਰ ਕਰੋਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ